ਸਾਡੇ ਰਾਜ ਵਿੱਚ ਸਿੱਖਿਆ ਪ੍ਰਣਾਲੀ ਹੈ ਜਿਹੜੀ ਉਹਦੇ ਵਿੱਚ ਪੰਜਾਬੀ ਭਾਸ਼ਾ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਪੰਜਾਬ ਦੀ ਜਿਹੜੀ ਪ ਮਾਤ ਭਾਸ਼ਾ ਹੈ ਉਹ ਕੀ ਹੈ ਪੰਜਾਬੀ ਹੈ ਠੀਕ ਹੈ ਜੀ ਜਿਹੜੀ ਪੰਜਾਬੀ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈ ਉਹ ਕੀ ਹੈ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹੈੈੈੈ ਉਨ੍ਹਾਂ ਨੇ ਇੱਕ ਆਪਣਾ ਟ੍ਰੈਂਡ ਸਮਝ ਲਉ ਬਣਾ ਲਿਆ ਕਿ ਉਹ ਇੰਗਲਿਸ਼ ਨੂੰ ਜ਼ਿਆਦਾ ਕੀ ਹੈ ਬੋਲਣਾ ਪਸੰਦ ਕਰਦੇ ਠੀਕ ਹੈ ਜਿਹੜੀ ਕੋਈ ਵੀ ਲੈਗਵੇਜ਼ ਆ ਭਾਸ਼ਾ ਹੈ ਉਹ ਮਾੜੀ ਨਹੀਂ ਹੈ ਹਰ ਇੱਕ ਦੀ ਆਪਣੀ ਥਾਂ ਕੀ ਹੈ ਇੱਕ ਵਧੀਆ ਵੈਲੀਯੂ ਹੈ ਪਰ ਅਸੀਂ ਪੰਜਾਬ ਰਾਜ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਮਾਤ ਭਾਸ਼ਾ ਹੈ ਪੰਜਾਬੀ ਉਹਦੇ ਉੱਤੇ ਹੀ ਸਾਨੂੰ ਆਪਣਾ ਰੱਖਣਾ ਚਾਹੀਦਾ ਹੈ ਇੱਕ ਇਸ ਕਰਕੇ ਜਿਹੜੇ ਸਾਡੇ ਮੁੱਖ ਮੰਤਰੀ ਜੀ ਹੈ ਭਗਵੰਤ ਮਾਨ ਜੀ ਉਹਨਾਂ ਨੇ ਪੰਜਾਬੀ ਨੂੰ ਸਾਂਭਣ ਲਈ ਇੱਕ ਹੁਣ ਰੂਲ ਬਣਾਤਾ ਕਿ ਅਗਰ ਪੰਜਾਬੀ ਵਿੱਚੋਂ ਕੋਈ ਬੱਚਾ ਸਪੋਸ਼ ਕਰੋ ਕਿ ਉਹ ਦਸਵੀਂ ਦੇ ਪੇਪਰ ਦੇ ਰਿਹਾ ਬੋਰਡ ਦੇ ਜਾਂ ਬਾਰਵੀਂ ਦੇ ਦੇ ਰਿਹਾ ਜੇ ਉਹ ਕਿਸੇ ਹੋਰ ਸਬਜੈਕਟ ਵਿੱਚੋਂ ਫ਼ੇਲ੍ਹ ਹੋ ਰਿਹਾ ਤਾਂ ਉਹਦੀ ਇੱਕ ਸਪਲੀ ਜਿਹਨੂੰ ਆਪਾਂ ਕੰਮਪਾਟਮੈਂਟ ਕਹਿੰਦੇ ਹਾਂ ਆ ਜਾਵੇਗੀ ਪਰ ਜੇਕਰ ਉਹ ਪੰਜਾਬੀ ਵਿੱਚੋਂ ਫ਼ੇਲ ਹੈ ਤਾਂ ਉਹ ਟੋਟਲੀ ਕੀ ਹੋ ਜਾਵੇਗਾ ਫ਼ੇਲ ਹੋ ਜਾਵੇਗਾ ਠੀਕ ਹੈ ਜੀ ਹੁਣ ਦੂਜਾ ਸੀ ਪੰਜਾਬੀ ਜਿਹੜੀ ਸਾਡੇ ਪੰਜਾਬ ਵਿੱਚ ਹੈ ਇਹਦੀ ਜਿਹੜੀ ਹੈਗੀ ਇਪੋਟੈਸ਼ ਸਾਨੂੰ ਕਿੱਥੋਂ ਪਤਾ ਲੱਗਦੀ ਹੈ ਕਿ ਅਗਰ ਕੋਈ ਦੂਜੇ ਰਾਜ ਦੇ ਇੱਥੇ ਆਉਂਦੇ ਹੈ ਠੀਕ ਹੈ ਚਾਹੇ ਉਹ ਹਿਮਾਚਲ ਦੇ ਚਾਹੇ ਹਰਿਆਣੇ ਦੇ ਆ ਜੇ ਉਹ ਪੰਜਾਬ ਵਿੱਚ ਕੋਈ ਨੌਕਰੀ ਚਾਹੁੰਦੇ ਆ ਕਰਨੀ ਸਰਕਾਰੀ ਤਾਂ ਉਹਨਾਂ ਨੂੰ ਵੀ ਕੀ ਹੈ ਜਿਹੜਾ ਪੰਜਾਬੀ ਦਾ ਪੇਪਰ ਹੈ ਉਹ ਦੇਣਾ ਲਾਜ਼ਮੀ ਹੋਏਗਾ ਅਤੇ ਉਹਨੂੰ ਪਾਸ ਕਰਨਾ ਲਾਜ਼ਮੀ ਹੋਏਗਾ ਠੀਕ ਹੈ ਜੀ ਇਸ ਲਈ ਕੀ ਹੈ ਕਿ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਸਾਡੀ ਮਾਂ ਬੋਲੀ ਹੈ ਇੱਥੋ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਕੀ ਹੈ ਉਹਦੇ ਪਰ ਆਪਣੀ ਜਿਹੜੀ ਇੱਕ ਕਮਾਂਡ ਹੈ ਉਹ ਬਣਾ ਕੇ ਰੱਖਣ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਆਪਣਾ ਜਿਹੜਾ ਰਾਜ ਹੈ ਉਹਨੂੰ ਵਧੀਆ ਇੱਕ ਅੱਗੇ ਜਾ ਕੇ ਵੀ ਪਰਮੋਂਟ ਕਰ ਸਕਣ